ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਲੋਕ ਇੱਕ ਦੂਜੇ ਨਾਲ ਜੁੜਨ ਅਤੇ ਮਨੋਰੰਜਨ ਦੇ ਮਾਧਿਅਮ ਨਾਲ ਕਮਿਊਨਿਟੀ ਬਣਾਉਣ ਦੇ ਲਈ ਕਈ ਮੁੱਖ ਤਰੀਕੇ ਹਨ ਜਿਵੇਂ ਕਿ ਜੁਆਇੰਟ ਪਰਿਵਾਰ ਥਿਏਟਰ ਤਿਉਹਾਰ ਜੁਆਇੰਟ ਪਰਿਵਾਰ ਵਿੱਚ ਰਲ ਕੇ ਕੋਈ ਰੋਟੀ ਖਾਣੀ ਜਿੱਦਾਂ ਕਿ ਹੁਣ ਆਪਾਂ ਪੰਜਾਬ ਦੀ ਰਲ ਕੇ ਗੱਲ ਕਰੀਏ ਪੰਜਾਬ ਵਿੱਚ ਕਈ ਜੁਆਇੰਟ ਪਰਿਵਾਰ ਹਨ ਜਿਸ ਵਿੱਚ ਸੱਸ ਸਹੁਰਾ ਚਾਚੀ ਚਾਚੀਆਂ ਤਾਇਆ ਤਾਈ ਅਤੇ ਮਾਂ ਪਿਓ ਬੱਚੇ ਸਾਰੇ ਰਲ ਮਿਲ ਕੇ ਰਹਿੰਦੇ ਹਨ ਅਤੇ ਰਲ ਮਿਲ ਕੇ ਰੋਟੀ ਖਾਂਦੇ ਹਨ ਮੁਸੀਬਤ ਵਿੱਚ ਜੇ ਇੱਕ ਨੂੰ ਲੋੜ ਪਵੇ ਤਾਂ ਦੂਸਰਾ ਉਸ ਕੋਲ ਭੱਜਾ ਅਉਂਦਾ ਹੈ ਅਤੇ ਲੋੜ ਪੈਣ 'ਤੇ ਉਸ ਦੀ ਮਦਦ ਕਰਦਾ ਹੈ ਜਿਸ ਤਰ੍ਹਾਂ ਹੁਣ ਇਹ ਪਰਿਵਾਰ ਦੀ ਗੱਲ ਹੈ ਹੁਣ ਮੈਂ ਜੇ ਸੁਸਾਇਟੀ ਦੀ ਗੱਲ ਕਰਾਂ ਤਾਂ ਉਸ ਵਿੱਚ ਇੱਕ ਕਲੱਬ ਬਣਿਆ ਹੁੰਦਾ ਹੈ ਜਿਸ ਵਿੱਚ ਇੱਕ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ ਤਾਂ ਸਭ ਇੱਕ ਸਾਰ ਰਲ ਕੇ ਰੋਟੀ ਖਾਂਦੇ ਹਨ ਅਤੇ ਬਾਹਰ ਘੁੰਮ ਕੇ ਆਪਣਾ ਦਿਨ ਵਧੀਆ ਬਣਾਉਂਦੇ ਹਨ ਇਸ ਨਾਲ ਉਹਨਾਂ ਵਿੱਚ ਪਿਆਰ ਵੀ ਬੜਾ ਵੱਧਦਾ ਹੈ ਜਿਵੇਂ ਹੋਰ ਥਿਰ ਫੈਸਟੀਵਲ ਵੀ ਕ ਕਰਵਾਉਣ ਲਈ ਆ ਆਦਿ ਜਿਵੇਂ ਨਾ ਟਸਾਲਾ ਨੁੱਕਰ ਨਾਟਕ ਇਹਦੇ ਵਿੱਚ ਵੀ ਆਪਸ ਵਿੱਚ ਕਾਫ਼ੀ ਸਬੰਧਿਤ ਹੁੰਦਾ ਹੈ ਠੀਕ ਹੈ ਅਤੇ ਪੰਜਾਬੀ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਲੋਕ ਦੂਜੇ ਨਾਲ ਜੁੜਦੇ ਨੇ ਮਨੋਰੰਜਨ ਅਤੇ ਮਾਧਿਅਮ ਨੂੰ ਠੀਕ ਠੀਕ ਆ ਜੀ ਧੰਨਵਾਦ ਜੀ